ਸਾਡੇ ਖੇਤਰ ਵਿੱਚ ਬਹੁਤ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ ਜਿਵੇਂ ਕਿ ਪੰਜਾਬੀ ਹਿੰਦੀ ਅੰਗਰੇਜ਼ੀ ਸਾਡੇ ਬੇ ਖੇਤਰ ਵਿੱਚ ਕਈ ਪ੍ਰਵਾਸੀ ਆ ਗਏ ਹਨ ਜਿਸ ਕਾਰਨ ਸਾਡੀ ਪੰਜਾਬੀ ਵਿੱਚ ਵੀ ਹਿੰਦੀ ਆ ਗਈ ਹੈ ਸਾਡੇ ਲੋਕ ਕਈ ਭਾਸ਼ਾਵਾਂ ਸਿੱਖਦੇ ਵੀ ਹਨ ਜਿਵੇਂ ਅੱਜ ਕੱਲ੍ਹ ਨੌਜਵਾਨ ਬਾਹਰ ਜਾ ਰਹੇ ਹਨ ਅਤੇ ਉਹ ਅੰਗਰੇਜ਼ੀ ਸਿੱਖਦੇ ਹਨ ਅਤੇ ਅੱਜ ਕੱਲ੍ਹ ਦੇ ਨੌਜਵਾਨ ਮਾਂ ਬੋਲੀ ਨੂੰ ਬੋਲਣ ਲੱਗੇ ਐਨਾ ਮਾਣ ਮਹਿਸੂਸ ਨਹੀਂ ਕਰਦੇ ਜਿੰਨਾ ਅੰਗਰੇਜ਼ੀ ਬੋਲਣ ਲੱਗੇ ਕਰਦੇ ਹਨ ਉਹ ਅੰਗਰੇਜ਼ੀ ਬੋਲਣ ਵਾਲੇ ਨੂੰ ਪੜ੍ਹਿਆ ਲਿਖਿਆ ਸਮਝਦੇ ਹਨ ਅਤੇ ਜੋ ਜਿਸ ਨੂੰ ਅੰਗਰੇਜ਼ੀ ਨਹੀਂ ਆਉਂਦੀ ਅਤੇ ਉਹ ਪੰਜਾਬੀ ਬੋਲਦਾ ਹੈ ਉਸ ਨੂੰ ਅਨਪੜ੍ਹ ਸਮਝਦੇ ਹਨ